ਹਾਂ ਪੰਜਾਬੀ ਬੋਲਣ ਦੇ ਵਿੱਚ ਪਹਿਲਾਂ ਸਿ ਸਿ ਸਿੱਖਿਆ ਸਟਾਰਟ ਕਰਨ ਤੋਂ ਸਿੱਖਿਆ ਸਟਾਰਟ ਕਰਨ ਸਮੇਂ ਮੈਨੂੰ ਇਸ ਵਿੱਚ ਕਾਫ਼ੀ ਸਮੱਸਿਆਵਾਂ ਆਈਆਂ ਜਿਵੇਂ ਹ ਹਰ ਹਰ ਪੜ੍ਹਾਈ ਸਟਾਰਟ ਕਰਨ ਲੱਗੇ ਹਰ ਸਬਜੈਕਟ ਦੇ ਵਿੱਚ ਸਾਨੂੰ ਪਰੇਸ਼ਾਨੀ ਹੁੰਦੀ ਹੈ ਇਸੇ ਤਰ੍ਹਾਂ ਪੰਜਾਬੀ ਵਿੱਚ ਵੀ ਹੋਈ ਸੀ ਪਰ ਹੁਣ ਹੌਲੀ ਹੌਲੀ ਜਿਵੇਂ ਅਸੀਂ ਦੂਜੀ ਤੀਜੀ ਦੇ ਵਿੱਚ ਅੱਗੇ ਅੱਗੇ ਵਧੇ ਉਸੇ ਤਰ੍ਹਾਂ ਸਾਨੂੰ ਹੌਲੀ ਹੌਲੀ ਪੰਜਾਬੀ ਲਿਖਣੀ ਬੋਲਣੀ ਆ ਗਈ ਆ ਸਾਡੀ ਫੈਮਿਲੀ ਦੇ ਵਿੱਚ ਵੀ ਪੰਜਾਬੀ ਬੋਲਿਆ ਕਰਦੇ ਸੀ ਮੇਰੀ ਮੰਮੀ ਵੀ ਪੰਜਾਬੀ ਬੋਲਿਆ ਕਰਦੇ ਸੀ ਅਸੀਂ ਪੰਜਾਬ ਵਿੱਚ ਰਹਿੰਦੇ ਆ ਇਸ ਕਰਕੇ ਪੰਜਾ ਪੰਜਾਬੀ ਮਾਂ ਬੋਲੀ ਸਾਡਾ ਸਾਡੀ ਭਾਸ਼ਾ ਬਣ ਗਈ ਅਸੀਂ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਇਸਨੂੰ ਵਰਤਦੇ ਹਾਂ ਹੁਣ ਮੈਂ ਦਸਵੀਂ ਬਾਰ੍ਹ ਬਾਰ੍ਹਵੀਂ ਕਲੀਅਰ ਕਰਲੀ ਅਤੇ ਹੁਣ ਮੈਂ ਪੰਜਾਬੀ ਵਿੱਚ ਚੰਗੀ ਤਰ੍ਹਾਂ ਨਿਪੁੰਨ ਹੋ ਚੁੱਕੀ ਹਾਂ ਹੁਣ ਮੈਂ ਪੰਜਾਬੀ ਵਿੱਚ ਕੁਝ ਵੀ ਲਿਖ ਸਕਦੀ ਹਾਂ ਪੜ੍ਹ ਲਿਖ ਸਕਦੀ ਹਾਂ ਕਿਸੇ ਨਾਲ ਵੀ ਕਿਸੇ ਵੀ ਤਰ੍ਹਾਂ ਬੋਲ ਸਕਦੀ ਹਾਂ ਇਸ ਲਈ ਮੈਨੂੰ ਹੁਣ ਪੰਜਾਬੀ ਬੋਲਣ 'ਚ ਹੁਣ ਕੋਈ ਪ੍ਰੇਸ਼ਾਨੀ ਨੀ ਆਉਂਦੀ ਹੁਣ ਮੈਨੂੰ ਮਾਣ ਹੈ ਕਿ ਮੈਂ ਪੰਜਾਬ ਦੇ ਵਿੱਚ ਰਹਿੰਦੀ ਹਾਂ ਅਤੇ ਪੰਜਾਬੀ ਮਾਂ ਬੋਲੀ ਬੋਲਦੀ ਹਾਂ